ਸਤਿ ਸ਼੍ਰੀ ਆਕਾਲ ਜੀ ਤੁਸੀਂ ਉਬਰ ਦੇ ਡਰਾਈਵਰ ਬੋਲ ਰਹੇ ਹੋ ਤੁਹਾਡੀ ਗੱਡੀ ਨੰਬਰ ਪੀ ਬੀ ਪੈਂਹਠ ਏ ਕੇ ਚੁਰਾਨਵੇਂ ਪੰਦਰਾਂ ਹੈ ਮੈਂ ਬਲਜਿੰਦਰ ਕੌਰ ਬੋਲ ਰਹੀ ਹਾਂ ਮੈਂ ਤੁਹਾਡੀ ਕੈਬ ਖਰੜ ਬੱਸ ਸਟੈਂਡ ਤੋਂ ਮੋਹਾਲੀ ਜਾਣ ਲਈ ਬੁੱਕ ਕੀਤੀ ਸੀ ਪਰ ਕਿਸੀ ਕਾਰਨ ਕਰਕੇ ਮੈਨੂੰ ਘਰ ਵਾਪਸ ਜਾਣਾ ਪਿਆ ਜੋ ਕਿ ਬੱਸ ਸਟੈਂਡ ਤੋਂ ਪੰਦਰਾਂ ਮਿੰਟ ਦੀ ਦੂਰੀ ਉੱਤੇ ਹੈ ਮੈਂ ਤੁਹਾਨੂੰ ਇਸ ਲਈ ਫ਼ੋਨ ਕੀਤਾ ਹੈ ਤਾਂ ਜੋ ਤੁਸੀਂ ਮੇਰੇ ਦੱਸੇ ਹੋਏ ਪਹਿਲੇ ਪਤੇ ਦੀ ਜਗ੍ਹਾ ਦੂਸਰੇ ਪਤੇ ਉੱਤੇ ਆ ਸਕੋ ਜੋ ਕਿ ਮਕਾਨ ਨੰਬਰ ਛੱਬੀ ਗਰੇਵਾਲ ਕਲੋਨੀ ਨੇੜੇ ਚੌਧਰੀ ਹੋਸਪੀਟਲ ਸਿੰਘਪੁਰਾ ਰੋਡ ਕੁਰਾਲੀ ਹੈ ਕਿਰਪਾ ਕਰਕੇ ਤੁਸੀਂ ਮੇਰੇ ਇਸ ਬਦਲੇ ਹੋਏ ਪਤੇ 'ਤੇ ਸਮੇਂ ਸਿਰ ਪਹੁੰਚ ਜਾਇਓ